ਹਾਂ ਮੈਨੂੰ ਪਾਣੀ ਦੀ ਕਮੀ ਦੀ ਉਮੀਦ ਹੈ ਅਤੇ ਇਹ ਕਹਿੰਦੇ ਮੈਨੂੰ ਬਹੁਤ ਦੁੱਖ ਹੋ ਰਿਹਾ ਹੈ ਕਿਉਂਕਿ ਪਾਣੀ ਸਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਪਾਣੀ ਸਾਡੇ ਜੀਵਨ ਵਿੱਚ ਸਭ ਤੋਂ ਮੁੱਖ ਰੋਲ ਪਲੇਅ ਕਰਦਾ ਹੈ ਕਿਉਂਕਿ ਪਾਣੀ ਤੋਂ ਬਿਨਾਂ ਕਿਸੇ ਦਾ ਕੋਈ ਜੀਵਨ ਨਹੀਂ ਹੈ ਅਤੇ ਪਾਣੀ ਨੂੰ ਸਾਨੂੰ ਬਚਾਉਣਾ ਚਾਹੀਦਾ ਹੈ ਪਾਣੀ ਨੂੰ ਬਚਾਉਣ ਦੇ ਲਈ ਸਾਨੂੰ ਪਾਣੀ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ ਇਸ ਨੂੰ ਬਚਾਉਣਾ ਚਾਹੀਦਾ ਹੈ ਆਲੇ ਦੁਆਲੇ ਵਿੱਚ ਅਗਰ ਕਿਤੇ ਕੋਈ ਵੀ ਪਾਣੀ ਦਾ ਨੁਕਸਾਨ ਕਰਦਾ ਹੈ ਤਾਂ ਸਾਨੂੰ ਉਸਨੂੰ ਰੋਕਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੇ ਘਰੋਂ ਹੀ ਉਸਦਾ ਸ਼ੁਰੂਆਤ ਕਰਨੀ ਚਾਹੀਦੀ ਹੈ ਸਾਨੂੰ ਬਾਰਿਸ਼ ਦਾ ਪਾਣੀ ਵੀ ਇਕੱਠਾ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਉਸ 'ਤੇ ਵੀ ਵਰਤੋਂ ਕਰ ਸਕੀਏ ਅਸੀਂ ਪਾਣੀ ਦੀ ਕਮੀ ਨਹੀਂ ਹੋਣ ਦਿਆ ਦੇਣੀ ਚਾਹੀਦੀ ਕਿਉਂਕਿ ਪਾਣੀ ਸਾਡੇ ਜੀਵਨ ਲਈ ਬਹੁਤ ਹੀ ਜ਼ਰੂਰੀ ਹੈ ਮੈਂ ਇਸ ਨੂੰ ਕਰਦੀ ਹਾਂ ਕਿ ਅਗਰ ਕਿਤੇ ਵੀ ਪਾਣੀ ਦਾ ਕੋਈ ਨੁਕਸਾਨ ਹੋ ਰਿਹਾ ਹੈ ਤਾਂ ਮੈਂ ਉਸਨੂੰ ਬਚਾਉਂਦੀ ਹਾਂ ਅਗਰ ਕਿਸੀ ਨੇ ਨਲ ਨੂੰ ਖੁੱਲ੍ਹਾ ਛੱਡ ਤਾ ਹੈ ਤਾਂ ਮੈਂ ਉਸਨੂੰ ਉਸੇ ਵੇਲੇ ਜਾ ਕੇ ਬੰਦ ਕਰ ਦਿੰਦੀ ਹਾਂ ਤਾਂ ਕਿ ਪਾਣੀ ਦੀ ਕਮੀ ਦਾ ਨਾ ਆ ਸਕੇ ਅਤੇ ਇਸ ਲਈ ਸਾਨੂੰ ਸਭ ਨੂੰ ਮਿਲ ਕੇ ਪਾਣੀ ਨੂੰ ਬਚਾਉਣਾ ਚਾਹੀਦਾ ਹੈ ਕਿਉਂਕਿ ਪਾਣੀ ਤੋਂ ਬਿਨਾਂ ਸਾਡਾ ਕੋਈ ਜੀਵਨ ਨਹੀਂ ਹੈ